ਮੈਂ ਕੁਝ ਦਿਨ ਪਹਿਲਾਂ ਐਮਾਜ਼ੋਨ ਰਾਹੀਂ ਇੱਕ ਔਡਰ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਮੈਂ ਕੈਂਸਲ ਕਰ ਦਿੱਤਾ ਸੀ ਅਤੇ ਉਸ ਦੀ ਪੇਮੈਂਟ ਮੈਂ ਐਮਾਜ਼ੋਨ ਵਾਲੇਟ ਦੇ ਰਾਹੀਂ ਕੀਤੀ ਹੋਈ ਸੀ ਪਰ ਉਸ ਦੇ ਕੈਂਸਲ ਕ ਕਰਨ ਤੋਂ ਬਾਵਜੂਦ ਵੀ ਮੇਰੀ ਪੇਮੈਂਟ ਰੀਫੰਡ ਨਹੀਂ ਹੋਈ ਇਸ ਲਈ ਮੈਂ ਆਪ ਜੀ ਨੂੁੰ ਬੇਨਤੀ ਕਰਾਂਗਾ ਕਿ ਮੇਰੀ ਮੇਰੀ ਪੇਮੈਂਟ ਜਲਦ ਤੋਂ ਜਲਦ ਰੀਫੰਡ ਕਰ ਦਿੱਤੀ ਜਾਵੇ